ਸਾਡੇ ਪਿੰਡ ਦੇ ਨੇੜੇ ਰਿਆਤ ਬਹਾਰਾ ਕੋਲੇਜ ਵਿੱਚ ਕਾਫ਼ੀ ਕੋਰਸ ਹਨ ਜੋ ਕਿ ਬਹੁਤ ਵਧੀਆ ਹਨ ਅਤੇ ਇਹਨਾਂ ਨੂੰ ਸਿੱਖਣਾ ਵੀ ਬਹੁਤ ਵਧੀਆ ਹੈ ਪਰ ਇੱਥੋਂ ਦੀ ਫ਼ੀਸ ਜ਼ਿਆਦਾ ਹੋਣ ਕਾਰਨ ਸਾਨੂੰ ਇੱਕ ਪਿੰਡ ਤੋਂ ਦੂਜੇ ਸ਼ਹਿਰ ਵਿੱਚ ਜਾਣਾ ਪੈਂਦਾ ਹੈ ਅਸੀਂ ਪੜ੍ਹਨ ਦੇ ਲਈ ਰੋਪੜ ਸਰਕਾਰੀ ਕੋਲੇਜ ਵਿੱਚ ਜਾਂਦੇ ਹਾਂ ਉੱਥੇ ਦੇ ਕੋਰਸਾਂ ਦੀ ਫ਼ੀਸ ਥੋੜ੍ਹੀ ਘੱਟ ਹੈ ਅਤੇ ਸਾਨੂੰ ਕਾਫ਼ੀ ਸਕੋਲਰਸ਼ਿਪ ਦੀਆਂ ਸਕੀਮਾਂ ਵੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ ਸਾਨੂੰ ਫ੍ਰੀ ਸਿਖਲਾਈ ਫ੍ਰੀ ਕੋਰਸ ਵਗੈਰਾ ਸਰਕਾਰ ਵੱਲੋਂ ਕਰਵਾਏ ਜਾਂਦੇ ਹਨ ਜਿਹਦੇ ਵਿੱਚ ਕਿ ਸਟੂ ਸਟੂਡੈਂਟਸ ਆਪਣਾ ਬੁੱਧੀ ਦਾ ਵਿਕਾਸ ਕਰਦੇ ਹੈ ਤਰ੍ਹਾਂ ਤਰ੍ਹਾਂ ਦੇ ਕੰਮ ਸਿੱਖ ਰਹੇ ਹਨ ਅਤੇ ਉਨਾਂ ਨੂੰ ਅੱਗੇ ਜੋਬ ਵਗੈਰਾ ਮਿਲਣ ਦੇ ਵੀ ਕੈਂਪ ਲਗਾਏ ਜਾਂਦੇ ਹਨ ਸਰਕਾਰੀ ਕੋਲੇਜ ਦੇ ਟੀਚਰ ਵੀ ਬਹੁਤ ਵਧੀਆ ਹਨ ਅਤੇ ਉਹ ਖੁਦ ਇੰਨੇ ਐਕਸਪੀਰੀਅੰਸ ਵਾਲੇ ਹਨ ਉਹ ਸਾਨੂੰ ਪੜ੍ਹਾਈ ਵਿੱਚ ਵੀ ਮਦਦ ਕਰਦੇ ਹਨ ਅਤੇ ਪੇਪਰਾਂ ਟਾਈਮ ਵੀ ਬਹੁਤ ਜ਼ਿਆਦਾ ਮਦਦ ਕਰਦੇ ਹਨ